ਜਿਵੇਂ ਕਿ ਮੈਂ ਪਹਿਲਾਂ ਦੱਸਿਆ ਹੈ ਕਿ ਮੈਂ ਭੰਗੜਾ ਨਹੀਂ ਕਰ ਸਕਦੀ ਪਰ ਫਿਰ ਵੀ ਮੈਂ ਭੰਗੜੇ ਦੀ ਕੋਰੀਓਗਰਾਫੀ ਕਰਨ ਦੇ ਵਿੱਚ ਆਪਣਾ ਰੁਝਾਨ ਰੱਖਦੀ ਹਾਂ ਮੈਨੂੰ ਭੰਗੜੇ ਨੂੰ ਭੰਗੜੇ ਨੂੰ ਮਹਿਸੂਸ ਕਰਨਾ ਹੀ ਬਹੁਤ ਵਧੀਆ ਲੱਗਦਾ ਮੈਂ ਹਰ ਓਹ ਕੋਸ਼ਿਸ਼ ਕਰਦੀ ਹਾਂ ਜਿਹਦੇ ਨਾਲ ਮੈਨੂੰ ਮਜ਼ਾ ਆਵੇ ਭਾਵੇਂ ਕਿ ਮੈਂ ਆਪਣੇ ਪੈਰਾਂ ਦੇ ਨਾਲ ਭੰਗੜਾ ਨਹੀਂ ਕਰ ਸਕਦੀ ਪਰ ਮੈਂ ਆਪਣੇ ਹੱਥਾਂ ਨਾਲ ਆਪਣੀਆਂ ਅੱਖਾਂ ਨਾਲ ਆਪਣੇ ਮਨ ਦੇ ਨਾਲ ਭੰਗੜਾ ਜ਼ਰੂਰ ਪਾਉਂਦੀ ਹਾਂ ਤਾਂ ਭੰਗੜਾ ਐਰੋਬਿਕਸ ਵੀ ਕੋਰੀਓਗਰਾਫੀ ਵੈਸੇ ਮੈਂ ਕੁਛ ਕਦੇ ਪ੍ਰੋਫੈਸ਼ਨਲ ਤੌਰ 'ਤੇ ਤਾਂ ਨਹੀਂ ਕੀਤੀ ਹਾਂ ਪਰ ਮੈਂ ਆਪਣੇ ਛੋਟੇ ਭੈਣ ਭਰਾਵਾਂ ਨੂੰ ਭੰਗੜਾ ਜ਼ਰੂਰ ਸਿਖਾਇਆ ਹੈ ਅਤੇ ਇਹ ਭੰਗੜੇ ਦੀ ਕੋਰੀਓਗਰਾਫੀ ਮੈਂ ਯੂਟਿਊਬ ਤੋਂ ਦੇਖ ਦੇਖ ਕੇ ਕਰਦੀ ਹਾਂ ਭੰਗੜਾ ਯੂਟਿਊਬ 'ਤੇ ਕਈ ਸਾਰੇ ਇੱਦਾਂ ਦੇ ਚੈਨਲ ਨੇ ਜਿਹਨਾਂ ਨੂੰ ਮੈਂ ਫੋਲੋ ਕੀਤਾ ਹੋਇਆ ਉਹ ਭੰਗੜਾ ਇਹੀ ਸਿਖਾਉਂਦੇ ਨੇ ਅਤੇ ਉਹਨਾਂ ਨੂੰ ਦੇਖ ਦੇਖ ਕੇ ਮੈਂ ਆਪਣੇ ਛੋਟੇ ਭੈਣ ਭਰਾਵਾਂ ਨੂੰ ਗਾਈਡ ਕਰਦੀ ਹਾਂ ਕਿ ਤੁਸੀਂ ਇੱਦਾਂ ਭੰਗੜਾ ਕਰਨਾ ਹੈ ਭੰਗੜਾ ਉਹਨਾਂ ਨੂੰ ਭੰਗੜੇ ਦੇ ਉਹਨਾਂ ਨੂੰ ਭੰਗੜੇ ਦੇ ਗੁਣ ਦੱਸਦੀ ਹਾਂ ਕਿ ਤੁਸੀਂ ਹਮੇਸ਼ਾ ਭੰਗੜਾ ਕਰਦੇ ਰਹੋ ਇਹਦੇ ਨਾਲ ਤੁਹਾਨੂੰ ਮਾਨਸਿਕ ਤਣਾਉ ਵੀ ਨਹੀਂ ਆਏਗਾ ਤੁਹਾਡਾ ਸਰੀਰ ਵੀ ਬਿਲਕੁਲ ਠੀਕ ਰਹੇਗਾ ਅਤੇ ਬਹੁਤ ਕੁਛ ਇੱਦਾਂ ਦੀ ਐਨਰਜੀ ਇੱਕ ਭੰਗੜੇ ਦੇ ਨਾਲ ਮਿਲਦੀ ਹੈ ਕਿ ਤੁਸੀਂ ਆਪਣੀ ਸਾਰੀ ਦਿਨ ਦੀ ਸਾਰੀ ਥਕਾਵਟ ਨੂੰ ਦੂਰ ਕਰ ਲੈਂਦੇ ਹੋ ਧੰਨਵਾਦ